ਮੇਰੀ ਭਾਸ਼ਾ ਪੰਜਾਬੀ ਹੈ ਪੰਜਾਬੀ ਵਿੱਚ ਯੂਟੀਊਬ ਚੈਨਲ ਕਾਫ਼ੀ ਜ਼ਿਆਦਾ ਜਾਣਕਾਰੀ ਮੁਹੱਈਆ ਕਰਵਾ ਰਹੇ ਨੇ ਜੋ ਸਪੋਰਟਸ ਇਨਵਾਇਰਮੈਂਟ ਅਤੇ ਆਸ ਪਾਸ ਦੀਆਂ ਖ਼ਬਰਾਂ ਔਰ ਬੱਚਿਆਂ ਲਈ ਐਜੂਕੇਸ਼ਨ ਪ੍ਰੋਗਰਾਮ ਇਸ ਦੇ ਨਾਲ ਨਾਲ ਪੰਜਾਬੀ ਵਿੱਚ ਗੀਤ ਸੰਗੀਤ ਅਤੇ ਹੋਰ ਸਿੱਖਿਆ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹੈ ਇਸ ਦੇ ਨਾਲ ਹੀ ਹਿੰਦੀ ਭਾਸ਼ਾ ਵਿੱਚ ਫਿਲਮਾਂ ਜੋ ਦੇਸ਼ ਵਿਦੇਸ਼ ਦੀ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ ਅਤੇ ਕਾਫ਼ੀ ਮਨੋਰੰਜਨ ਕਰਦੀਆਂ ਨੇ ਜਿਸ ਨਾਲ ਸਾਰੇ ਆਪਣਾ ਵਕਤ ਅੱਛੀ ਤਰ੍ਹਾਂ ਆਪਣੇ ਘਰ ਵਿੱਚ ਗੁਜ਼ਾਰਦੇ ਨੇ ਅਤੇ ਆਪਣੀ ਮਨਪਸੰਦ ਦੇ ਪ੍ਰੋਗਰਾਮ ਦੇਖ ਕੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਨੇ ਯੂਟੀਊਬ ਚੈਨਲ ਆਉਣ ਦੇ ਨਾਲ ਬਹੁਤ ਹੀ ਸਸਤਾ ਅਤੇ ਸੁਵਿਧਾਜਨਿਕ ਔਰ ਆਪਣੀ ਮੋਬਾਇਲ ਦੇ ਉੱਪਰ ਹੀ ਦੇਖਣ ਵਾਲੇ ਪ੍ਰੋਗਰਾਮ ਆਸਾਨੀ ਨਾਲ ਮੁਹੱਈਆ ਹੋ ਜਾਂਦੇ ਹਨ ਜਿਸ ਜਗ੍ਹਾ 'ਤੇ ਵੀ ਨੈਟਵਰਕ ਉਪਲੱਬਧ ਹੈ ਤੁਸੀਂ ਆਪਣੀ ਪਸੰਦ ਦਾ ਚੈਨਲ ਲਗਾ ਕੇ ਯੂਟੀਊਬ ਚੈਨਲ ਲਗਾ ਕੇ ਹਿੰਦੀ ਜਾਂ ਪੰਜਾਬੀ ਉਸ ਦਾ ਆਨੰਦ ਮਾਣ ਸਕਦੇ ਹੋ